ਹੈਲੋ ਹੈਲੋ ਹਾਂਜੀ ਕੋਣ ਸਰ ਹਾਂਜੀ ਹਾਂਜੀ ਵੀਰ ਜੀ

ਮੇਰੇ ਹਾਂਜੀ ਬੱਚੇ ਆਪਣੇ ਇੱਥੇ ਪੜ੍ਹਦੇ ਜੀ ਵਾਈਐਸ ਸਕੂਲ 'ਚ ਹੰਡਿਆਏ ਜੀ ਇੱਕ ਬੇਟੀ ਹੈ ਜੀ ਥਰਡ ਕਲਾਸ 'ਚ ਅਤੇ ਬੇਟਾ ਫਿਫਥ ਕਲਾਸ 'ਚ ਹਾਂਜੀ ਹਾਂ ਸਰ ਸ਼ੂਰੂ ਤੋਂ ਹੀ ਇੱਥੇ ਪੜ੍ਹਦੇ ਆ ਜੀ ਸ਼ੁਰੂ ਨਰਸਰੀ ਤੋਂ ਹਾਂ ਦੋ ਬੱਚੇ ਆ ਇੱਕ ਬੇਟੀ ਥਰਡ 'ਚ ਅਤੇ ਬੇਟਾ ਫਿਫਥ ਹੈ ਜੀ ਅੱਛਾ ਹਲੇ ਸਟਾਰਟਿੰਗ 'ਚ ਹੀ ਲਾਉਣਾ ਹੈਜੀ ਪਲੇਅ ਵੇ 'ਚ ਅੱਛਾ ਜੀ ਪਲੇਅ ਵੇ 'ਚ ਜਾਂਦਾ ਸੀ ਅੱਛਾ ਅੱਛਾ ਠੀਕ ਹੈ ਅੱਛਾ ਜੀ ਹਾਂਜੀ ਹਾਂ ਇਹ ਏਰੀਏ ਦਾ ਸਭ ਤੋਂ ਵਧੀਆ ਸਕੂਲ ਹੈ ਜੀ ਬਰਨਾਲੇ ਏਰੀਏ 'ਚ ਜਿੰਨੇ ਵੀ ਸਕੂਲ ਦੇਖੇ ਅਸੀਂ ਅਸੀਂ ਵੀ ਪਹਿਲਾਂ ਜਦੋਂ ਲਾਉਣਾ ਸੀ ਕਾਫੀ ਉਲਝਣ 'ਚ ਸੀ ਫਿਰ ਅਸੀਂ ਸਾਰਾ ਕੁਝ ਦੇਖ ਕੇ ਫਿਰ ਇੱਥੇ ਵਾਈ ਐੱਸ ਸਕੂਲ ਹੰਡਿਆਏ 'ਚ ਹਾਂ ਪਹਿਲਾਂ ਬੇਟੇ ਨੂੰ ਲਾਇਆ ਜੀ ਅਤੇ ਫਿਰ ਬੇਟੀ ਨੂੰ ਵੀ ਇੱਥੇ ਹੀ ਲਾ ਤਾ ਵੀ ਚਲੋ ਇੱਕ ਥਾਂ 'ਤੇ ਆਉਣ ਜਾਣਾ ਸੌਖਾ ਰਹਿੰਦਾ ਅਤੇ ਸਟਾਫ ਵਗੈਰਾ ਇੱਥੇ ਠੀਕ ਹੈ ਵਧੀਆ ਜੀ ਸਹੂਲਤਾਂ ਜਿਹੜੀਆਂ ਵੀ ਹੈ ਸਪੋਰਟਸ ਦਾ ਹੈਗਾ ਜੀ ਹਾਂਜੀ ਹਾਂਜੀ ਇੱਥੇ ਇਹਨਾਂ ਦਾ ਆਪਦਾ ਸਵਿਮਿੰਗ ਪੂਲ ਬਣਿਆ ਹੋਇਆ ਜੀ ਅਤੇ ਆ ਵੀ ਆਪਣੇ ਸ਼ੂਟਿੰਗ ਰੇਂਜ ਬਣੀ ਹੋਈ ਹੈ ਅਤੇ ਉਹ ਗਰਾਊਂਡ ਵਧੀਆ ਬਣੇ ਹੋਏ ਨੇ ਜੀ ਹਾਂ ਅੱਛਾ ਅੱਛਾ ਅੱਛਾ ਅੱਛਾ ਨਹੀਂ ਨਹੀਂ ਵਧੀਆ ਜੀ ਫੁਟਬਾਲ 'ਚ ਅੱਛਾ ਅੱਛਾ ਨਹੀਂ ਨਹੀਂ ਇਹਨਾਂ ਕੋਲ ਤਾਂ ਮਲਟੀਗ੍ਰਾਊਂਡ ਹੈ ਜੀ ਸਾਰੇ ਤਰ੍ਹਾਂ ਦੀਆਂ ਗੇਮਾਂ ਦੀ ਹੈਗੀ ਹੈਗੀ ਅਤੇ ਮੇਰਾ ਬੇਟਾ ਵੀ ਫੁੱਟਬਾਲ ਦੇ ਵਿੱਚ ਇਹਨਾਂ ਦੇ ਹੈਗੇ ਟੀਮ 'ਚ ਜਾਂਦਾ ਸਕੂਲ ਵੱਲ ਤੋਂ ਅਤੇ ਇਹ ਸਾਰਾ ਗਰਾਊਂਡ ਹੈਗਾ ਜੀ ਅਤੇ ਇੰਡੋਰ ਗੇਮ ਵੀ ਹੈਗੀਆਂ ਹੈਗੀਆਂ ਜਿਵੇਂ ਆਹਾ ਮਤਲਬ ਸਾਰੇ ਇੰਡੋਰ ਅਤੇ ਆਊਟਡੋਰ ਸਾਰੇ ਤਰ੍ਹਾਂ ਦੀਆਂ ਗੇਮਾਂ ਹੈਗੀਆਂ ਇੱਥੇ ਜੀ ਨਹੀਂ ਟੀਚਰ ਸਾਰੇ ਪੂਰੇ ਆ ਜੀ ਹਰ ਇੱਕ ਤਰ੍ਹਾਂ ਦੇ ਮਤਲਬ ਸਬਜੈਕਟ ਟੀਚਰ ਆਪਦੇ ਵਧੀਆ ਕੁਆਲੀਫਾਈਡ ਹੈ ਅਤੇ ਵਧੀਆ ਪੇਰੈਂਟਸ ਨਾਲ ਮਤਲਬ ਜਿਹੜੀ ਪੀਟੀਐਮ 'ਤੇ ਜਾਂਦੇ ਨੇ ਤੁਸੀਂ ਉਦੋਂ ਵਧੀਆ ਗੱਲਬਾਤ ਸਾਰੀ ਕਰਦੇ ਨੇ ਜੇ ਕੋਈ ਬੱਚੇ ਨੂੰ ਪ੍ਰੋਬਲਮ ਆਪਾਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਕੋਈ ਵੀ ਗੱਲ ਆਪਣੀ ਸੁਣਦੇ ਨੇ ਇਹੋ ਜਿਹੀ ਗੱਲ ਨਹੀਂ ਹੈ ਆਪਣੀ ਗੱਲ ਨਹੀਂ ਸੁਣਦੇ ਅਤੇ ਬੱਚੇ ਕਨੀ ਫਿਰ ਪਰਸਨਲੀ ਧਿਆਨ ਦਿੰਦੇ ਨੇ ਹਾਂਜੀ ਹਾਂਜੀ ਹਾਂ ਨਹੀਂ ਬੇਫਿਕਰ ਹੋ ਕੇ ਲਾ ਦੋ ਜੀ ਬੇ ਬਾਕੀ ਤੁਹਾਡੀ ਮਰਜ਼ੀ ਹੈ ਊਂ ਤਾਂ ਸਾਡੇ ਹਿਸਾਬ ਨਾਲ ਤਾਂ ਵਧੀਆ ਇੱਥੇ ਵੀ ਸਾਡੇ ਦੋਨੇ ਬੱਚੇ ਇੱਥੇ ਆ ਕਾਫੀ ਟਾਈਮ ਹੋ ਗਿਆ ਬੇਟੇ ਨੂੰ ਪੰ ਛੇ ਸੱਤ ਸਾਲ ਹੋ ਗਏ ਅਤੇ ਗੁੜੀਆ ਨੂੰ ਵੀ ਤਿੰਨ ਚਾ ਚਾਰ ਸਾਲ ਹੋ ਗਏ ਅਤੇ ਇੱਥੇ ਪੜ੍ਹਦੇ ਓ ਅਤੇ ਤੁਸੀਂ ਦੇਖ ਲਓ ਮਨ ਬਣਾ ਲਓ ਵਧੀਆ ਹੈਗਾ ਹਾਂ ਇੱਕ ਵਾਰੀ ਤੁਸੀਂ ਸਕੂਲ 'ਤੇ ਵਿਜਿਟ ਕਰਿਓ ਗੱਲਬਾਤ ਕਰਿਓ ਹਾਂਜੀ ਹਾਂ ਤੁਹਾਨੂੰ ਜੇ ਠੀਕ ਲੱਗਿਆ ਤਾ ਉੱਥੇ ਹਾਂਜੀ ਹਾਂਜੀ